ਜਿਵੇਂ ਕਿ ਮੈਂ ਟੀਚਰ ਦੀ ਜੋਬ ਕਰਦੀ ਹਾਂ ਹੈ ਨਾ ਅਤੇ ਮੈਂ ਆਪਣੀ ਜੋਬ ਵਿੱਚ ਨੇੜਲੇ ਪਿੰਡਾਂ ਦਾ ਕਸਬਿਆਂ ਦਾ ਦੌਰਾ ਕਰਦੀ ਹੀ ਰਹਿੰਦੀ ਹਾਂ ਜਿਵੇਂ ਕਿ ਐਡਮਿਸ਼ਨ ਦੇ ਦਿਨਾਂ ਵਿੱਚ ਦਾਖਲੇ ਦੇ ਦਿਨਾਂ ਵਿੱਚ ਬੱਚਿਆਂ ਨੂੰ ਘਰ ਘਰ ਜਾ ਕੇ ਜਾਂ ਡੋਰ ਟੂ ਡੋਰ ਕਨਵਿਨਸਿੰਗ ਅਸੀਂ ਉਹਨਾਂ ਨੂੰ ਜਾਂ ਕੋਲ ਜਾਂਦੇ ਹਾਂ ਹੈ ਨਾ ਹੋਰ ਤੋਂ ਹੋਰ ਵੀ ਕਈ ਵਾਰੀ ਸਰਕਾਰ ਦੀਆਂ ਕੁਝ ਸਕੀਮਾਂ ਜਿਹੜੀਆਂ ਕਿ ਹੁੰਦੀਆਂ ਨੇ ਸਰਵੇ ਕੋਈ ਆ ਜਾਂਦਾ ਆ ਮਰਦਮਸ਼ੁਮਾਰੀ ਆ ਜਾਂਦੀ ਆ ਕੋਈ ਫ੍ਰੀ ਘਰਾਂ ਦਾ ਸਰਵੇ ਕਰਨ ਵਾਲੀਆਂ ਉਦੇਸ਼ਾਂ ਦੇ ਨਾਲ਼ ਮੈਂ ਜਾਂਦੀ ਰਹਿੰਦੀ ਹਾਂ ਪਰ ਜ਼ਿਆਦਾਤਰ ਮੈਂ ਸਕੂਲ ਦੇ ਕੰਮਾਂ ਤੋਂ ਹੀ ਜਾਂਦੀ ਹਾਂ ਜਿਵੇਂ ਕਿ ਕਨਵਿਨਸਿੰਗ ਦੇ ਟਾਈਮ ਐਡਮਿਸ਼ਨ ਦੇ ਟਾਈਮ ਮੇਰਾ ਕੋਲੇਜ ਵੀ ਹੈ ਕੋਲੇਜ ਨਾਲ਼ ਸੰਬੰਧਿਤ ਵੀ ਜਾਂਦੇ ਰਹਿੰਦੇ ਹਾਂ ਅਤੇ ਮੇਰੇ ਕੋਲੇਜ ਮੇਰੀ ਸੰਸਥਾ ਦਾ ਸਕੂਲ ਵੀ ਹੈ ਜਿਸ ਵਾਸਤੇ ਛੋਟੇ ਬੱਚਿਆਂ ਦੇ ਲਈ ਵੀ ਅਸੀਂ ਜਾਂਦੇ ਬਾਕੀ ਨਾਲ਼ ਦੇ ਪਿੰਡਾਂ ਦਾ ਕਸਬਿਆਂ ਦਾ ਦੌਰਾ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਪਣੇ ਸਕੂਲ ਦੇ ਆਪਣੇ ਕੋਲੇਜ ਦੇ ਵਧੀਆ ਅਰੇਂਜਮੈਂਟਸ ਬਾਰੇ ਦੱਸ ਕੇ ਉਹਨਾਂ ਨੂੰ ਐਡਮਿਸ਼ਨ ਵਾਸਤੇ ਪ੍ਰੋਤਸਾਹਿਤ ਕਰਦੇ ਰਹਿੰਦੇ ਹਾ ਧੰਨਵਾਦ